ਮੈਨੂੰ ਪਾਲਤੂ ਜਾਨਵਰ ਰੱਖਣਾ ਪਸੰਦ ਨਹੀਂ ਹੈ ਕਿਉਂਕਿ ਜੇਕਰ ਅਸੀਂ ਕੋਈ ਜਾਨਵਰ ਰੱਖਦੇ ਹਾਂ ਤਾਂ ਉਹਨਾਂ ਦੀ ਦੇਖਭਾਲ ਕਰਨੀ ਪੈਂਦੀ ਹੈ ਖਾਣ ਪੀਣ ਦਾ ਸਮਾਂ ਨਿਸ਼ਚਿਤ ਰੱਖਣਾ ਪੈਂਦਾ ਹੈ ਘੁਮਾਉਣਾ ਪੈਂਦਾ ਹੈ ਅਤੇ ਜਿੱਥੇ ਜਾਨਵਰ ਰੱਖਣਾ ਹੋਵੇ ਉਸ ਜਗ੍ਹਾ ਦੀ ਸਾਫ਼ ਸਫ਼ਾਈ ਵੀ ਰੱਖਣੀ ਪੈਂਦੀ ਹੈ ਮੈਂ ਪੜ੍ਹਦੀ ਹਾਂ ਇਸ ਕਰਕੇ ਮੇਰੇ ਕੋਲ਼ ਇੰਨਾ ਸਮਾਂ ਨਹੀਂ ਹੈ ਕਿ ਮੈਂ ਆਪਣੇ ਤੋਂ ਇਲਾਵਾ ਕਿਸੀ ਹੋਰ ਦੀ ਜ਼ਿੰਮੇਵਾਰੀ ਚੁੱਕ ਸਕਾਂ ਮੈਨੂੰ ਨਹੀਂ ਲੱਗਦਾ ਕਿ ਮੇਰੇ ਘਰ ਵਿੱਚ ਵੀ ਕਿਸੇ ਨੂੰ ਇਸ ਵਿੱਚ ਦਿਲਚਸਪੀ ਹੈ ਉਹਨਾਂ ਕੋਲ ਇੰਨਾ ਸਮਾਂ ਨਹੀਂ ਹੈ ਕਿ ਉਹ ਜਾਨਵਰ ਦਾ ਧਿਆਨ ਰੱਖ ਸਕਣ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਮੈਂ ਪਾਲਤੂ ਜਾਨਵਰ ਨੂੰ ਰੱਖਣ ਲਈ ਜ਼ਿੰਮੇਵਾਰ ਹਾਂ ਮੈਨੂੰ ਪਾਲਤੂ ਜਾਨਵਰ ਰੱਖਣ ਵਿੱਚ ਕੋਈ ਦਿਲਚਸਪੀ ਨਹੀਂ ਹੈ